ਜਿਵੇਂ ਕਿ ਮੇਰੇ ਮਾਮਾ ਜੀ ਦੀ ਮੌਤ ਪੰਜ ਮਈ ਦੋ ਹਜਾਰ ਚੋਵੀ ਨੂੰ ਹੋਈ ਸੀ ਤੇ ਮੇਰਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰੀ ਹੋਣ ਸਰਕਾਰੀ ਨੌਕਰੀ ਹੋਣ ਦੇ ਕਰਕੇ ਉਹਨਾਂ ਨੂੰ ਵੀ ਅੱਗੇ ਦੇ ਦਿੱਤੀ ਜਾਣੀ ਚਾਹੀਦੀ ਸੀ ਫਿਰ ਉਸ ਤੋਂ ਬਾਅਦ ਉਹਨਾਂ ਦੇ ਮੁੰਡੇ ਨੂੰ ਉਹ ਨੌਕਰੀ ਦੇਣ ਲਈ ਸਰਕਾਰੀ ਨੌਕਰੀ ਵਾਲੇ ਉਹਨਾਂ ਦੇ ਮੌਤ ਦਾ ਰਿਕਾਰਡ ਮੰਗਦੇ ਹਨ ਪਰ ਮੇਰੇ ਖਿਆਲ ਨਾਲ ਉਹ ਰਿਕਾਰਡ ਸਹੀ ਦਰਜ ਸਹੀ ਢੰਗ ਨਾਲ ਦਰਜ ਨਹੀਂ ਕੀਤਾ ਗਿਆ ਜਿਹਦੇ ਲਈ ਤੁਸੀਂ ਮੈਂ ਜਾਣਣਾ ਚਾਹੁੰਦੀ ਆ ਕਿ ਸਾਨੂੰ ਕਿਹਦੇ ਵਿੱਚ ਤਕਲੀਫ਼ੀ ਆ ਰਹੀ ਹੈ ਜੇ ਕੋਈ ਵੀ ਰੁਕਾਵਟ ਆ ਰਹੀ ਐ ਤੇ ਸਾਨੂੰ ਦੱਸ ਦੱਸ ਦਿੱਤਾ ਜਾਵੇ ਜਿਹਦੇ ਕਰਕੇ ਅਸੀਂ ਉਹ ਰੁਕਾਵਟ ਨੂੰ ਖਤਮ ਕਰ ਸਕੀਏ ਤੇ ਅਗਲੇ ਬੰਦੇ ਦਾ ਵੀ ਬਹੁਤ ਜਿਆਦਾ ਫਾਇਦਾ ਹੋ ਸਕੇ ਤੇ ਉਹ ਵੀ ਕੱਲ ਤੋਂ ਕੰਮ ਤੇ ਜਾ ਸਕੇ ਇਹਨਾਂ ਇਸ ਮੌਤ ਕਰਕੇ ਉਹਨਾਂ ਦੇ ਘਰ ਨੂੰ ਬਹੁਤ ਵੱਡਾ ਨੁਕਸਾਨ ਝੇਲਣਾ ਪਿਆ ਐ ਜਿਹਦੇ ਵਿੱਚ ਕੀ ਉਹਨਾਂ ਲਈ ਰੋਟੀ ਪਾਣੀ ਕੱਪੜਾ ਉਹਨਾਂ ਦੇ ਲੋਨ ਦੇ ਪੈਸੇ ਦਾ ਵੀ ਬਹੁਤ ਇੰਤਜ਼ਾਮ ਕਰਨਾ ਔਖਾ ਹੋ ਰਿਹਾ ਹ ਤੇ ਮੇਰਾ ਮੰਨਣਾ ਹੈ ਕਿ ਜਿੰਨਾ ਜਲਦੀ ਹੋ ਸਕੇ ਇਹ ਮੌਤ ਰਿਕਾਰਡ ਸਹੀ ਢੰਗ ਨਾਲ ਰਿਕਾਰਡ ਕੀਤਾ ਜਾਏ ਉਸੇ ਤਰੀਕੇ ਦੇ ਨਾਲ ਅਸੀਂ ਅੱਗੇ ਵੱਧ ਸਕਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਕੀ ਇਹ ਵੀ ਸਹੀ ਢੰਗ ਨਾਲ ਹੋ ਕੇ ਉਹਨਾਂ ਦੇ ਜੀਵਨ ਖੁਸ਼ਹਾਲ ਰਹੇ ਤੇ ਸਾਨੂੰ ਉਹਨਾਂ ਦੀ ਕੋਈ ਵੀ ਪਰਵਾਹ ਇੰਨੀ ਨਾ ਰਹੇ ਜਿਹਦੇ ਕਰਕੇ ਉਹਨਾਂ ਨੂੰ ਭੁੱਖ ਤੋਂ ਵੀ ਤੜਪਣਾ ਪਵੇ